ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਮੈਂ ਮੱਧ ਪੀੜ੍ਹੀ ਦਾ ਹਿੱਸਾ ਹਾਂ ਮੇਰੀ ਉਮਰ ਤਕਰੀਬਨ ਚੁਤਾਲੀ ਸਾਲ ਦੀ ਹੈ ਮੈਂ ਮੱਧ ਪੀੜ੍ਹੀ ਦੇ ਅੰਦਰ ਆਉਂਦਾ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਮੱਧ ਪੀੜ੍ਹੀ ਦੀ ਸੋਚ ਨੂੰ ਅਨੁਭਵ ਕੀਤਾ ਹੈ ਜਿਸ ਵਿੱਚ ਜੋ ਪੁਰਾਣੀ ਪੀੜ੍ਹੀ ਹੈ ਉਸ ਵਿੱਚ ਜ਼ਿਆਦਾਤਰ ਬਜ਼ੁਰਗ ਆਉਂਦੇ ਹਨ ਜੋ ਕਿ ਪੰਜਾਹ ਜਾਂ ਸੱਠ ਸਾਲ ਦੀ ਉਮਰ ਤੋਂ ਜਾਂ ਉਸਦੀ ਉਮਰ ਦੇ ਵਿੱਚ ਜਾਂ ਪੰਜਾਹ ਸਾਲ ਤੋਂ ਜੋ ਉੱਪਰ ਹਨ ਜਿਸ ਤਰ੍ਹਾਂ ਸਾਡੇ ਆਪਣੇ ਦਾਦਾ ਜੀ ਅਤੇ ਮੇਰੇ ਪਿਤਾ ਜੀ ਹਨ ਇਹ ਇਹ ਚਾਹੁੰਦੇ ਹਨ ਕਿ ਸਾਡੇ ਬੱਚੇ ਵਧੀਆ ਪੜ੍ਹਾਈ ਕਰਕੇ ਵਧੀਆ ਨੌਕਰੀਆਂ 'ਤੇ ਲੱਗਣ ਅਤੇ ਵਧੀਆ ਆਪਣੇ ਜੀਵਨ ਨੂੰ ਸਫਲ ਕਰਨ ਪਰ ਇਸ ਵਿੱਚ ਪੰਜਾਹ ਪ੍ਰਸੈਂਟ ਬਜ਼ੁਰਗ ਅਤੇ ਪੁਰਾਣੀ ਪੀੜ੍ਹੀ ਇਹੋ ਜਿਹੀ ਹੈ ਇਹ ਚਾਹੁੰਦੀ ਹੈ ਜੋ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਜਿਸ ਤਰ੍ਹਾਂ ਕਨੇਡਾ ਅਮੈਰੀਕਾ ਅਤੇ ਹੋਰ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਲਈ ਭੇਜਣ ਭੇਜਦੇ ਹਨ ਪਰ ਉਹ ਬੱਚੇ ਪੜ੍ਹਨ ਤੋਂ ਬਾਅਦ 'ਚ ਆਪਣੇ ਦੇਸ਼ਾਂ ਨੂੰ ਨਹੀਂ ਪਰਤਦੇ ਜਿਸਦੇ ਨਾਲ ਜੋ ਪੰਜਾਬ ਦੀ ਅਤੇ ਹੋਰ ਦੇਸ਼ਾਂ ਦੀ ਜੋ ਵੀ ਹੈ ਇਨਕਮ ਬੱਚਿਆਂ ਦੀ ਉਹ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਪਰ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਵਿੱਚ ਬਹੁਤ ਸਮਾਨਤਾਵਾਂ ਹਨ ਅੱਜ ਦੀ ਪੀੜ੍ਹੀ ਦਾ ਨੌਜਵਾਨ ਇਹ ਚਾਹੁੰਦਾ ਹੈ ਕਿ ਮੈਨੂੰ ਪੈਰੇ ਪਹਿਲੇ ਮਾਂ ਬਾਪ ਪਾਸੋਂ ਪੈਸਾ ਮਿਲ ਜਾਵੇ ਅਤੇ ਮੈਂ ਉਸ ਪੈਸੇ ਨਾਲ ਜਾਂ ਤਾਂ ਬਾਹਰਲੇ ਦੇਸ਼ਾਂ ਵਿੱਚ ਜਾਵਾਂ ਸੈਰ ਸਪਾਟਾ ਕਰਾਂ ਘੁੰਮਾਂ ਫਿਰਾਂ ਜਾਂ ਫਿਰ ਉਸੇ ਉਹਨਾਂ ਦੇਸ਼ਾਂ ਵਿੱਚ ਕਿਸੇ ਤਰ੍ਹਾਂ ਕੋਈ ਵੀਜ਼ਾ ਮਿਲ ਜਾਵੇ ਤਾਂ ਮੈਂ ਉਹਨਾਂ ਦੇਸ਼ਾਂ ਵਿੱਚ ਜਾ ਕੇ ਸੈੱਟ ਹੋ ਜਾਵਾਂ ਅਤੇ ਉਸ ਪੈਸੇ ਨਾਲ ਮੈਂ ਐਸ਼ ਕਰਾਂ ਜਾਂ ਫਿਰ ਮੈਂ ਪਿੰਡਾਂ ਦੀ ਜ਼ਿੰਦਗੀ ਨੂੰ ਛੱਡ ਕੇ ਸ਼ਹਿਰ ਵਿੱਚ ਘਰ ਲੈ ਕੇ ਇੱਕ ਜ਼ਿੰਦਗੀ ਨੂੰ ਜਿਊਵਾਂ ਪਰ ਪੁਰਾਣੀ ਪੀੜ੍ਹੀ ਇਸਦੇ ਉਲਟ ਹੈ ਉਹ ਇਸ ਨੂੰ ਬਿਲਕੁਲ ਬੁਰਾ ਮੰਨਦੀ ਹੈ ਉਹ ਇਹ ਚਾਹੁੰਦੀ ਹੈ ਕਿ ਮੇਰਾ ਬੱਚਾ ਮੇਰੇ ਕੋਲ ਰਹੇ ਕਿ ਇਸ ਪੈਸੇ ਦੀ ਸਾਂਭ ਸੰਭਾਲ ਕਰੇ ਇਸ ਨਾਲ ਹੋਰ ਜ਼ਿਆਦਾ ਜ਼ਮੀਨ ਲਵੇ ਜ਼ਮੀਨ ਲੈ ਕੇ ਮ ਕੋਈ ਵਧੀਆ ਵਾਹ ਵਹਾਈ ਖੇਤੀ ਕਰੇ ਅਤੇ ਇਸ ਜ਼ਮੀਨ ਤੋਂ ਹੋਰ ਦੁੱਗਣੀ ਜ਼ਮੀਨ ਬਣਾ ਕੇ ਆਪਣੇ ਆਉਣ ਵਾਲੇ ਬੱਚਿਆਂ ਨੂੰ ਜੋ ਹੈ ਇਹ ਜ਼ਮੀਨ ਵਧੀਆ ਹੋਰ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਤਰੀਕੇ ਨਾਲ ਜ਼ਿਆਦਾ ਪੈਸਾ ਦੇ ਸਕੇ ਜਿਸ ਤਰ੍ਹਾਂ ਬਜ਼ੁਰਗ ਪੀੜ੍ਹੀ ਦੀ ਸੋਚਣੀ ਹੈ ਉਹ ਇਹ ਚਾਹੁੰਦੀ ਹੈ ਕਿ ਜੋ ਸਾਡੀ ਨਵੀਂ ਪੀੜ੍ਹੀ ਹੈ ਉਹ ਵੀ ਸਾਡੇ ਵਾਂਗੂੰ ਸੋਚੇ ਪਰ ਇਹਨਾਂ ਦੇ ਵਿੱਚ ਬਹੁਤ ਸਮਾਨਤਾਵਾਂ ਹਨ ਜੋ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਨੂੰ ਵੱਖ ਵੱਖ ਕਰਦੀਆਂ ਹਨ